ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਮੇਰਾ ਨਾਮ ਪੁਸ਼ਪਿੰਦਰ ਕੌਰ ਹੈ ਮੈਂ ਇੱਕ ਤੁਹਾਨੂੰ ਇੱਕ ਵੇਰਵਾ ਪੁੱਛਣਾ ਸੀ ਅਸੀਂ ਸਭ ਪਰਿਵਾਰ ਨੇ ਸਾਡਾ ਪਿੰਡ ਮਿਤੀ ਪੱਚੀ ਫਰਵਰੀ ਦੋ ਹਜ਼ਾਰ ਚੌਵੀ ਨੂੰ ਜਾਣ ਦਾ ਪਲ ਆਯੋਜਨ ਕੀਤਾ ਹੈ ਅਤੇ ਮੈਂ ਤੁਹਾਡੇ ਕੋਲੋਂ ਤੁਹਾਡੀ ਟਰੈਵਲ ਏਜੰਸੀ ਤੋਂ ਇਹ ਜਾਂਚ ਬ ਕਰਾਉਣਾ ਚਾਹੁੰਦੀ ਹਾਂ ਕਿ ਪੱਚੀ ਫਰਵਰੀ ਦੋ ਹਜ਼ਾਰ ਚੌਵੀ ਨੂੰ ਕੋਈ ਵੀ ਕੈਬ ਜਾਂ ਕੋਈ ਸੱਤ ਸੀਟਰ ਵਾਲੀ ਵੱਡੀ ਗੱਡੀ ਦਾ ਇੰਤਜ਼ਾਮ ਹੋ ਸਕਦਾ ਹੈ ਤਾਂ ਜੋ ਮੈਂ ਆਪਣੇ ਪਰਿਵਾਰ ਦੇ ਨਾਲ ਸਾਡਾ ਪਿੰਡ ਜਾ ਸਕਾਂ ਮੈਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿਓ ਤਾਂ ਜੋ ਅਸੀਂ ਤੁਹਾਡੀ ਟਰੈਵਲ ਏਜੰਸੀ ਦੀਆਂ ਸੁੱਖ ਸੁਵਿਧਾਵਾਂ ਦਾ ਲਾਭ ਉਠਾ ਸਕੀਏ ਸਤਿ ਸ਼੍ਰੀ ਅਕਾਲ ਜੀ